ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਤੁਸੀਂ ਬਰਿੰਦਰ ਸਿੰਘ ਬੋਲਦੇ ਹੋ ਮੈਂ ਤੁਹਾਡਾ ਨੰਬਰ ਜੀ ਆਪਣੇ ਦੋਸਤ ਕੋਲੋਂ ਲਿੱਤਾ ਸੀਗਾ ਜੀ ਹਾਂ ਜੀ ਟੂਰਿਸਟ ਗਾਈਡ ਕਰਨ ਲਈ ਹਾਂਜੀ ਤੁਸੀਂ ਜੀ ਮੈਨੂੰ ਦੱਸ ਸਕਦੇ ਮਹਾਰਾਜ ਰਣਜੀਤ ਸਿੰਘ ਬਾਰੇ ਜੀ ਘੁੰਮਣ ਵਾਲੀਆਂ ਥਾਵਾਂ ਹਾਂਜੀ ਕਿੱਥੇ ਕਿੱਥੇ ਹੈ ਜਿੱਦਾਂ ਜੀ ਤੁਸੀਂ ਹਾਂਜੀ ਅੱਛਾ ਜੀ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਮੈਂ ਤੁਹਾਨੂੰ ਜੀ ਜ਼ਰੂਰ ਫੋਨ ਕਰਕੇ ਦੱਸੂੰਗੀ ਜੇ ਜਾਣਾ ਹੋਇਆ ਜਿੱਦਾਂ ਟੂਰ 'ਤੇ ਦੁਬਾਰੇ ਫੋਨ ਕਰੂੰਗੀ